ਹੈਲੋ ਸਤਿ ਸ਼੍ਰੀ ਅਕਾਲਤੁਸੀਂ ਰਜੀਸ਼ ਬੋਲ ਰਹੇ ਹੋ ਤੁਸ ਮੈਨੂੰ ਉਬਰ ਕੈਬ ਵਾਲਿਆਂ ਨੇ ਤੁਹਾਡਾ ਨੰਬਰ ਦਿੱਤਾ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੱਲ੍ਹ ਰਾਤੀ ਮੇਰੀ ਦਸ ਸਾਢੇ ਨੌ ਵਜੇ ਦੀ ਫਲਾਈਟ ਹੈ ਮੈਂ ਦਿੱਲੀ ਏਅਰਪੋਰਟ ਤੋਂ ਕੈਨੇਡਾ ਜਾਣਾ ਹੈ ਅਤੇ ਕੱਲ੍ਹ ਰਾਤੀ ਨੌ ਵਜੇ ਦੇ ਹਿਸਾਬ ਨਾਲ਼ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਸੀਂ ਕਿੰਨੇ ਟਾਈਮ ਨਾਲ ਚੱਲੀਏ ਅਤੇ ਅਸੀਂ ਪੂਰੇ ਟਾਈਮ ਨਾਲ਼ ਪਹੁੰਚ ਸਕੀਏ ਅਤੇ ਮੇਰੇ ਨਾਲ਼ ਮੇਰੇ ਬਜ਼ੁਰਗ ਮਾਂ ਬਾਪ ਵੀ ਹੈ ਅਤੇ ਇਸ ਹਿਸਾਬ ਨਾਲ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਸ ਰਸਤੇ ਤੋਂ ਅਸੀਂ ਜਾ ਸਕੀਏ ਜਿਸ ਦੇ ਨਾਲ਼ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਅਤੇ ਉਹ ਆਰਾਮ ਨਾਲ ਜਾ ਸਕਣ ਅਤੇ ਅਸੀਂ ਆਪਣੇ ਪੂਰੇ ਟਾਈਮ ਨਾਲ਼ ਪਹੁੰਚ ਸਕੀਏ ਅਤੇ ਉਸ ਹਿਸਾਬ ਨਾ ਆਪਣਾ ਟਾਈਮ ਜਿਹੜਾ ਸਾਨੂੰ ਦੱਸ ਦਿਓ ਅਤੇ ਅਸੀਂ ਅਸੀਂ ਉਸ ਏਅਰ ਦਿੱਲੀ ਏਅਰਪੋਟ 'ਤੇ ਟਾਈਮ ਨਾਲ਼ ਪਹੁੰਚ ਸਕੀਏ